ਸਾਡੇ ਖੇਤਰ ਦੇ ਵਿੱਚ ਬਹੁਤ ਹੀ ਸਾਰੇ ਸੈਰ ਸਪਾਟੇ ਦੇ ਸਥਾਨ ਹਨ ਇੱਥੋਂ ਦੇ ਇੱਥੋਂ ਦੇ ਸਥਾਨ ਜਦੋਂ ਤੋਂ ਸੈਰ ਸਪਾਟੇ ਲਈ ਮਸ਼ਹੂਰ ਹੋਏ ਹਨ ਉਦੋਂ ਤੋਂ ਲੋਕਾਂ ਨੂੰ ਰੁਜ਼ਗਾਰ ਮਿਲਿਆ ਹੈ ਜਿਹਦੇ ਵਿੱਚ ਕਿ ਲੋਕਾਂ ਨੇ ਭੋਜਨ ਨੂੰ ਲੈ ਕੇ ਇੱਕ ਬਹੁਤ ਹੀ ਵਧੀਆ ਭੋਜਨ ਨੂੰ ਲੈ ਕੇ ਇੱਕ ਬਹੁਤ ਹੀ ਵਧੀਆ ਰੁਜ਼ਗਾਰ ਸ਼ੁਰੂ ਕੀਤਾ ਹੈ ਇੱਥੋਂ ਦੇ ਲੋਕ ਇੱਥੋਂ ਦਾ ਭੋਜਨ ਜੋ ਕਿ ਪੰਜਾਬ ਦੇ ਵਿੱਚ ਫੇਮਸ ਹੈ ਨੂੰ ਬਣਾਉਂਦੇ ਹਨ ਅਤੇ ਬਾਹਰੋਂ ਆਏ ਸੈਰ ਸਪਾਟਾ ਕਰਨ ਆਏ ਲੋਕਾਂ ਨੂੰ ਲੋਕਾਂ ਨੂੰ ਇਹਦਾ ਸਵਾਦ ਚਖਾਉਂਦੇ ਹਨ ਅਤੇ ਜਿਸ ਨਾਲ ਉਨ੍ਹਾਂ ਉਨ੍ਹਾਂ ਨੂੰ ਇੱਥੋਂ ਦੇ ਭੋਜਨ ਬਾਰੇ ਜਾਣਕਾਰੀ ਵੀ ਮਿਲਦੀ ਹੈ ਅਤੇ ਇੱਥੋਂ ਦੇ ਭੋਜਨ ਨੂੰ ਸੁਆਦ ਵੀ ਮਿਲਦਾ ਹੈ ਅਤੇ ਉਨ੍ਹਾਂ ਨੂੰ ਉਨ੍ਹਾਂ ਅਤੇ ਮਤਲਬ ਇੱਥੋਂ ਦੇ ਲੋਕਾਂ ਨੂੰ ਉਸ ਚੀਜ਼ ਦੇ ਨਾਲ ਰੁਜ਼ਗਾਰ ਵੀ ਮਿਲਦਾ ਹੈ ਅਤੇ ਇੱਥੋਂ ਦੇ ਹੋਰ ਹੋਰ ਜਿਵੇਂ ਦੇਖਿਆ ਜਾਵੇ ਤਾਂ ਲੋਕ ਇੱਥੋਂ ਦੇ ਲੋਕ ਕੁੜਤਾ ਪਜਾਮਾ ਪਾਉਂਦੇ ਹਨ ਜੇ ਜਿਹੜੀ ਜਿਸ ਦੇ ਨਾਲ ਕਿਸੇ ਵੀ ਮਨੁੱਖ ਦੀ ਇੱਕ ਅਲੱਗ ਇੱਕ ਅਲੱਗ ਪਹਿਚਾਣ ਹੁੰਦੀ ਹੈ ਇਹ ਇਸ ਚੀਜ਼ ਇਸ ਚੀਜ਼ ਨੂੰ ਦੇਖਦੇ ਹੋਏ ਬਹੁਤ ਸਾਰੇ ਸ ਸੈਲਾਨੀ ਇੱਥੇ ਆਉਂਦੇ ਹਨ ਅਤੇ ਇੱਥੋਂ ਦੇ ਕੱਪੜੇ ਕੱਪੜੇ ਖਰੀਦਦੇ ਹਨ ਅਤੇ ਬਹੁਤ ਹੀ ਸਸਤੇ ਮਿਲਦੇ ਹਨ ਅਤੇ ਇੱਥੋਂ ਦੇ ਹੋਰ ਵਿਸ਼ੇਸ਼ਤਾਵਾਂ ਜਿਵੇਂ ਦੇਖਿਆ ਜਾਵੇ ਤਾਂ ਇੱਥੋਂ ਦੇ ਲੋਕ ਬਹੁਤ ਹੀ ਮਿਲਣਸਾਰ ਹਨ ਜਿਹੜੇ ਕਿ ਬਾਹਰਲੇ ਲੋਕਾਂ ਨੂੰ ਬਹੁਤ ਪਸੰਦ ਕਰਦੇ ਹਨ ਅਤੇ ਉਹਨਾਂ ਨੂੰ ਸੈਟ ਸਪਾਟੇ ਲਈ ਇੱਕ ਅਲੱਗ ਮਤਲਬ ਗਾਇਡ ਵੀ ਪ੍ਰੋਵਾਈਡ ਕਰਦੇ ਹਨ